ਅੱਜ ਕੱਲ੍ਹ ਸਮਾਰਟ ਫੋਨ 'ਚ ਬੜੀਆ ਐਪਸ ਆ ਗਈਆਂ ਵਾ ਜੋ ਜਿੱਦਾਂ ਅਸਨੈਪਚੈਟ ਟਵਿੱਟਰ ਫੇਸਬੁੱਕ ਇੰਸਟਾਗਰਾਮ ਇੰਸਟਾਗਰਾਮ ਫੇਸਬੁੱਕ ਫੋ ਅਡੋਬ ਫੋਟੋਸ਼ੋੋਪ ਅਡੋਪ ਸਕੈਨਰ ਅ ਜੋ ਕਿ ਬਹੁਤ ਹੈਲਪਫੁਲ ਹਨ ਅੱਜ ਕੱਲ੍ਹ ਦੇ ਬੱਚਿਆਂ ਅਹ ਲਈ ਜੋ ਅਸੀਂ ਬਹੁਤ ਯੂਜ਼ ਕਰਦੇ ਹਾਂ ਅੱਜ ਕੱਲ੍ਹ ਅਤੇ ਨਾਲ ਹੀ ਉਹ ਸਾਨੂੰ ਬਹੁਤ ਹੈਲਪ ਦਿੰਦੀਆਂ ਹਨ ਸਮਾਰਟਫਾਰਮ ਦੇ ਹੋਰ ਵੀ ਬਹੁਤ ਫਾਇਦੇ ਹਨ ਜਿੱਦਾਂ ਅ ਸਟੱਡੀ 'ਚ ਕੰਮ ਆਉਂਦੇ ਹਨ ਅਸੀਂ ਕੁਛ ਵੀ ਸਰਚ ਕਰਨਾ ਹੋਵੇ ਤਾਂ ਯੂਟੀਊਬ 'ਤੇ ਜਾ ਕੇ ਅਸੀਂ ਸਰਚ ਕਰ ਲੈਂਦੇ ਹਾਂ ਕੁਛ ਵੀ ਗੂਗਲ ਤੇ ਸਰਚ ਕਰ ਲੈਂਦੇ ਹਾਂ ਅਤੇ ਨਾਲ ਹੀ ਸਾਨੂੰ ਬਹੁਤ ਮਦਦ ਕਰਦੇ ਆ ਪੜ੍ਹਾਈ ਵਿੱਚ ਕੋਈ ਚੀਜ਼ ਦੀ ਨੋੋਲੇਜ਼ 'ਚ ਬਹੁਤ ਹੈਲਪਫੁਲ ਆ ਸਮਾਰਟ ਫੋਨ ਤਾਂ ਉਹਨਾਂ ਦੇ ਨੁਕਸਾਨ ਵੀ ਬਹੁਤ ਹਨ ਜਿੱਦਾਂ ਸਮਾਰਟ ਫੋਨ ਅਸੀਂ ਜੇ ਜ਼ਿਆਦਾ ਯੂਜ ਕਰਾਂਗੇ ਸਾਡੀ ਆਈਸ ਖ਼ਰਾਬ ਹੋ ਜਾਣਗੀਆਂ ਅਸੀਂ ਅਡਿਕਟ ਹੋ ਜਾਂਗੇ ਕਈ ਬੱਚੇ ਗੇਮਸ 'ਚ ਇੰਨੇ ਅਡਿਕਟ ਹੋ ਜਾਂਦੇ ਆ ਕਿ ਉਹ ਬਾਅਦ 'ਚੋਂ ਹਾਰਮਫੁੱਲ ਹੁੰਦੀਆਂ ਵਾਈ ਮਤਲਬ ਕਿ ਫੈਮਲੀਜ਼ ਲਈ ਅ ਸਕੈਮਸ ਬਹੁਤ ਹੁੰਦੇ ਆ ਅੱਜ ਕੱਲ੍ਹ ਸਮਾਰਟ ਫੋਨ ਤੋਂ ਅੱਜ ਕੱਲ੍ਹ ਬੱਚੇ ਵੀ ਬਹੁਤ ਯੂਜ ਕਰਦੇ ਆ ਗੇਮਸ ਫੋਨਸ ਯੂਟਿਊਬ ਬਹੁਤ ਯੂਜ ਕਰਦੇ ਆ ਜੋ ਕਿ ਉਹਨਾਂ ਦੀ ਆਈਸ 'ਤੇ ਇਫੈਕਟ ਪੈਂਦਾ ਸਟੱਡੀ 'ਤੇ ਇਫੈਕਟ ਪੈਂਦਾ ਅਤੇ ਉਹਨਾਂ ਦੇ ਬੱਚੇ ਬਾਹਰ ਖੇਡਣ ਨਹੀਂ ਜਾਂਦੇ ਹਰ ਵਕਤ ਫੋਨ 'ਚ ਵੜੇ ਰਹਿੰਦੇ ਆ ਉਹ ਬਹੁਤ ਨੁਕਸਾਨ ਹੈ ਬੱਚਿਆਂ ਲਈ ਅਤੇ ਈਵਨ ਕਿ ਵੱਡਿਆਂ ਲਈ ਵੀ ਅੱਜ ਕੱਲ੍ਹ ਜਿੱਦਾਂ ਸਕੈਮਸ ਹੁੰਦੇ ਹਨ ਨਾਲ ਹੀ ਇਹ ਹੈਕ ਹੋ ਜਾਂਦੀਆਂ ਆਈਡੀਸ ਬਹੁਤ ਨੁਕਸਾਨ ਵੀ ਹੈ ਅਤੇ ਕਈ ਫਾਇਦੇ ਵੀ ਆ ਉਹਨਾਂ ਦੇ